ਸਾਡੇ ਫਾਜ਼ਿਲਕਾ ਖੇਤਰ ਵਿੱਚ ਸਰਕਾਰੀ ਗੈਰ ਸਰਕਾਰੀ ਤੇ ਅਰਧ ਸਰਕਾਰੀ ਸਕੂਲ ਤੇ ਕਾਲਜ ਹਨ ਜਿਹੜੇ ਕਲਾਂ ਰੂਪਾਂ ਵਿੱਚ ਸਿਖਲਾਈ ਤੇ ਵਿੱਦਿਅਕ ਪ੍ਰੋਗਰਾਮ ਪੇਸ਼ ਕਰਦੇ ਹਨ ਇਹਨਾਂ ਦੇ ਵਿੱਚ ਜੇ ਆਪਾਂ ਕਰੀਏ ਸਰਕਾਰੀ ਕਾਲਜਾਂ ਦੀ ਗੱਲ ਤੇ ਉਸ ਵਿੱਚ ਐਮਆਰ ਕਾਲਜ ਹੈ ਤੇ ਇਸੇ ਤਰ੍ਹਾਂ ਐਥੇ ਹੋਰ ਕਈ ਆਰਟ ਐਂਡ ਕਰਾਫਟ ਦੇ ਕਾਲਜ ਹਨ ਜਿਸ ਵਿੱਚ ਕੀ ਆਈਟੀਆਈ ਜਿਨਦੇ ਵਿੱਚ ਇੱਕ ਆਈਟੀਆਈ ਸਰਕਾਰੀ ਹੈ ਜਬਕੀ ਦੋ ਜਾਂ ਤਿੰਨ ਆਈਟੀਆਈ ਪ੍ਰਾਈਵੇਟ ਹੈ ਐਸੇ ਤਰ੍ਹਾਂ ਸਕੂਲਾਂ ਦੇ ਵਿੱਚ ਵੀ ਸਰਕਾਰੀ ਗਰਲਸ ਸਕੂਲ ਹੈ ਜਿਸ ਦੇ ਵਿੱਚ ਆਰਟ ਤੇ ਕਲਾ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਉਸ ਤੋਂ ਅਲਾਵਾ ਹੋਰ ਵੀ ਕਈ ਸੰਸਥਾਵਾਂ ਨੇ ਜਿਹੜੀਆਂ ਕੀ ਪ੍ਰਾਈਵੇਟ ਰੂਪ ਤੇ ਚੱਲ ਰਹੀਆਂ ਨੇ ਜਿਹੜੀਆਂ ਸ਼ਾਇਦ ਐਫੀਲੇਟਿਡ ਤਾਂ ਨਹੀਂ ਹਨ ਪਰ ਉਹ ਇਹ ਪ੍ਰੋਗਰਾਮਾਂ ਨੂੰ ਲਈ ਬੱਚਿਆਂ ਨੂੰ ਤਿਆਰ ਕਰ ਰਹੀਆਂ ਨੇ